ਭਾਰਤੀ ਸਾਹਿਤ ਵਿੱਚ ਔਰਤਾਂ ਬਾਰੇ ਬਹੁਤ ਕੁਝ ਲਿਖਿਆ ਹੈ ਅਤੇ ਅਸੀਂ ਉਹਨਾਂ ਵਿਸ਼ਿਆਂ ਉੱਤੇ ਚਾਨਣ ਕਰਦੇ ਹਾਂ ਜਿਨ੍ਹਾਂ ਵਿੱਚ ਭਰੂਣ ਹੱਤਿਆ ਅਤੇ ਹੋਰ ਵੀ ਚੀਜ਼ਾਂ ਸ਼ਾਮਿਲ ਹਨ ਜਿਵੇਂ ਕਿ ਛੋਟੇ ਹੁੰਦੇ ਹੀ ਬੱਚੀਆਂ ਨੂੰ ਮਾਰ ਦਿੱਤਾ ਜਾਂਦਾ ਹੈ ਉਹਨਾਂ ਨੂੰ ਜਿਉਣ ਦਾ ਅਧਿਕਾਰ ਨਹੀਂ ਦਿੱਤਾ ਜਾਂਦਾ ਪੁਰਾਣੇ ਸਮੇਂ ਵਿੱਚ ਇੱਦਾਂ ਦੀਆਂ ਚੀਜ਼ਾਂ ਬਹੁਤ ਹੁੰਦੀਆਂ ਸਨ ਜਿਨ੍ਹਾਂ ਵਿੱਚ ਕੁੜੀਆਂ ਨੂੰ ਜ਼ਿਆਦਾ ਬਾਹਰ ਨਿਕਲਣ ਦੀ ਵੀ ਇਜਾਜ਼ਤ ਨਹੀਂ ਸੀ ਉਹਨਾਂ ਦੇ ਪੈਦਾ ਹੋਣ 'ਤੇ ਹੀ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਸੀ ਅਤੇ ਜਦੋਂ ਵਿਆਹੁਣ ਦੀ ਵਾਰੀ ਆਉਂਦੀ ਸੀ ਤਾਂ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਦਹੇਜ ਨਾਲ ਤੋਲ ਕੇ ਦਿੱਤਾ ਜਾਂਦਾ ਸੀ ਜੋ ਕਿ ਇੱਕ ਸੌਦੇ ਦੇ ਬਰਾਬਰ ਸੀ ਕੁੜੀਆਂ ਨੂੰ ਮਾਰਨ ਦੇ ਲਈ ਉਹਨਾਂ ਦਾ ਪਹਿਲਾਂ ਟੈਸਟ ਕਰਵਾਇਆ ਜਾਂਦਾ ਸੀ ਤਾਂ ਕਿ ਪਤਾ ਲੱਗ ਜਾਵੇ ਕਿ ਕੁੜੀ ਹੈ ਜਾਂ ਮੁੰਡਾ ਜਿਸ ਦੇ ਨਾਲ ਲੋਕਾਂ ਨੂੰ ਜਦੋਂ ਪਤਾ ਲੱਗਦਾ ਸੀ ਘਰਦਿਆਂ ਨੂੰ ਜਦੋਂ ਪਤਾ ਲੱਗਦਾ ਸੀ ਕਿ ਕੁੜੀ ਹੈ ਤਾਂ ਉਹਨਾਂ ਨੂੰ ਮਾਰਨ ਦੇ ਲਈ ਕਹਿ ਦਿੱਤਾ ਜਾਂਦਾ ਸੀ ਜੋ ਕਿ ਬਿਲਕੁਲ ਗਲਤ ਸੀ ਅੱਜ ਕੱਲ੍ਹ ਦੇ ਸਮੇਂ ਵਿੱਚ ਇਹ ਥੋੜ੍ਹਾ ਘਟ ਗਿਆ ਹੈ ਪਰੰਤੂ ਪਹਿਲਾਂ ਦੇ ਸਮੇਂ ਵਿੱਚ ਇਹ ਬਹੁਤ ਸੀ ਅਤੇ ਕੁੜੀਆਂ ਨੂੰ ਇੰਨਾ ਜ਼ਿਆਦਾ ਮਹੱਤਤਾ ਨਹੀਂ ਦਿੱਤੀ ਜਾਂਦੀ ਸੀ ਕੁੜੀਆਂ ਵੀ ਮੁੰਡਿਆਂ ਦੇ ਬਰਾਬਰ ਹੀ ਹਨ ਕੁੜੀਆਂ ਲਈ ਬਹੁਤ ਕੁਝ ਹੈ ਅਤੇ ਕੁੜੀਆਂ ਬਹੁਤ ਕੁਛ ਕਰ ਸਕਦੀਆਂ ਹਨ ਆਪਣੇ ਲਈ ਆਪਣੇ ਘਰਦਿਆਂ ਲਈ ਵੀ ਉਹ ਇੱਕ ਟਕ ਖੜੇ ਹੋ ਸਕਦੀਆਂ ਹਨ ਕੁੜੀਆਂ ਨੂੰ ਉਹਨਾਂ ਦੇ ਜ਼ਿੰਮੇਵਾਰੀ ਵੀ ਪਤਾ ਹੈ ਅਤੇ ਉਹ ਆਪਣੀ ਜ਼ਿੰਮੇਵਾਰੀਆਂ ਨਿਭਾ ਸਕਦੀਆਂ ਹਨ ਧੰਨਵਾਦ